ਭਾਰਤ ਵਿੱਚ ਕਈ ਤਰ੍ਹਾਂ ਦੀਆਂ ਨਾਚ ਸ਼ੈਲੀਆਂ ਹਨ ਜਿਵੇਂ ਕਿ ਭੰਗੜਾ ਗਿੱਧਾ ਝੂਮਰ ਕੱਥਕ ਡਾਂਡੀਆ ਆਦਿ ਵਰਗੇ ਕਈ ਤਰ੍ਹਾਂ ਦੀਆਂ ਨਾਚ ਸ਼ੈਲੀਆਂ ਹਨ ਠੀਕ ਹੈ ਭਾਰਤ ਵਿੱਚ ਇੱਕ ਮਸ਼ਹੂਰ ਡਾਂਸਰ ਸਪਨਾ ਚੌਧਰੀ ਹੈ ਜੋ ਕਿ ਹਰਿਆਣੇ ਵਿੱਚ ਹੈ ਠੀਕ ਹੈ ਪੰਜਾਬ ਵਿੱਚ ਭੰਗੜਾ ਖੁਸ਼ੀ ਦੇ ਤੌਰ 'ਤੇ ਪਾਇਆ ਜਾਂਦਾ ਹੈ ਜਦੋਂ ਪੰਜਾਬ ਵਿੱਚ ਲੋਕ ਖੁਸ਼ ਹੁੰਦੇ ਹਨ ਤਾਂ ਉਹ ਭੰਗੜਾ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਜਾਹਿ ਇਜ਼ਹਾਰ ਕਰਦੇ ਹਨ ਠੀਕ ਹੈ ਅਤੇ ਜਿਹੜਾ ਕੱਥਕ ਹੈ ਉਹ ਕਲਕੱਤੇ ਵਿਚ ਹੈ ਕਰ ਕਰਿਆ ਜਾਂਦਾ ਹੈ ਅਤੇ ਡਾਂਡੀਆਂ ਉਹ ਗੁਜਰਾਤ ਵਿੱਚ ਖੇਲਿਆ ਜਾਂਦਾ ਹੈ ਅਤੇ ਭਾਰਤ ਵਿਚ ਇੱਦਾਂ ਹੋਰ ਤਰੀਕਰ ਕਈ ਤਰ੍ਹਾਂ ਦੇ ਇਹ ਰਾਜ ਹਨ ਜਿਹਨਾਂ ਵਿੱਚ ਆਪਣੇ ਆਪਣੇ ਆਪਣੇ ਰਾਜ ਮੁਤਾਬਿਕ ਆਪਣੇ ਆਪਣੇ ਖਰਚੇ ਮੁਤਾਬਿਕ ਇਹ ਸ਼ਿਆ ਨਾਚ ਸ਼ੈਲੀਆਂ ਕੀਤੀਆਂ ਜਾਂਦੀਆਂ ਹਨ